ਸਾਡੇ ਰੂਪਨਗਰ ਇਲਾਕੇ ਵਿੱਚ ਹਰ ਸਮੂਹ ਦੇ ਲੋਕ ਰਹਿੰਦੇ ਹਨ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਅਤੇ ਅਲੱਗ ਅਲੱਗ ਵੱਖ ਵੱਖ ਖੇਤਰ ਦੇ ਲੋਕ ਵੀ ਇੱਥੇ ਰਹਿੰਦੇ ਹਨ